ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਆਪਣੀ ਬੱਸ ਯਾਤਰਾ ਦਾ ਵਰਣਨ ਕਰ ਸਕਦੀ ਹਾਂ ਜਿਵੇਂ ਕਿ ਮੈਂ ਇੱਕ ਛੋਟੀ ਹੁੰਦੀ ਸੀ ਪਹਿਲੋਂ ਆਪਣੇ ਪਾਪਾ ਦੇ ਨਾਲ਼ ਯਾਤਰਾ ਅਨੰਦਪੁਰ ਸਾਹਿਬ ਦੀ ਗਏ ਸਾਂ ਅਸੀਂ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ ਜਾਣੀ ਸੀ ਅਤੇ ਮੈਨੂੰ ਤਾਂ ਰਾਤ ਨੂੰ ਹੀ ਬੜਾ ਚਾਅ ਚੜ੍ਹ ਗਿਆ ਕਿ ਅਸੀਂ ਸਵੇਰੇ ਆਨੰਦਪੁਰ ਸਾਹਿਬ ਜਾਣਾ ਹੈ ਮੈਂ ਤਾਂ ਰਾਤ ਨੂੰ ਹੀ ਆਪਣੇ ਸਾਰੇ ਬੈਗ 'ਚ ਕੱਪੜੇ ਵਗੈਰਾ ਪਾ ਲਏ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਪਾ ਲਈਆਂ ਮੈਨੂੰ ਬਹੁਤ ਚਾਅ ਚੜ੍ਹ ਗਿਆ ਫਿਰ ਅਸੀਂ ਸਵੇਰੇ ਉੱਠੇ ਇਸ਼ਨਾਨ ਕੀਤਾ ਮੇਰੀ ਮੰਮਾ ਵੀ ਤਿਆਰ ਹੋਏ ਮੇਰੇ ਪਾਪਾ ਵੀ ਤਿਆਰ ਹੋਏ ਅਸੀਂ ਸਾਰੇ ਤਿਆਰ ਹੋ ਕੇ ਬੱਸ ਸਟੈਂਡ ਗਏ ਅਸੀਂ ਉਹ ਵਾਲੀ ਬੱਸ 'ਤੇ ਨਹੀਂ ਗਏ ਸਾਡੇ ਮੁਹੱਲੇ 'ਚੋਂ ਹੀ ਗੁਰਦੁਆਰੇ ਦੇ ਵਿੱਚੋਂ ਇੱਕ ਬੱਸ ਜਾਣੀ ਸੀ ਅਸੀਂ ਉਹ ਬੱਸ 'ਤੇ ਗਏ ਸੀ ਮੈਨੂੰ ਤਾਂ ਬੱਸ ਦੇ ਨਾਂ 'ਤੇ ਵੀ ਬੜਾ ਹੀ ਚਾਅ ਚੜ੍ਹ ਗਿਆ ਮੈਨੂੰ ਬੱਸ 'ਤੇ ਬਹਿ ਕੇ ਯਾਤਰਾ ਕਰਨ ਜਾਣ ਦਾ ਬੜਾ ਹੀ ਮਜ਼ਾ ਆਉਂਦਾ ਹੈ ਅਤੇ ਮੈਂ ਬਾਰੀ ਵਾਲੀ ਸੀਟ 'ਤੇ ਬਹਿਣਾ ਹੀ ਪਸੰਦ ਕਰਦੀ ਮੈਂ ਤਾਂ ਆਪਣੀ ਭੈਣ ਦੇ ਨਾਲ਼ ਲੜ ਕੇ ਬਾਰੀ ਵਾਲੀ ਸੀਟ 'ਤੇ ਬੈਠੀ ਜਦਕਿ ਉਹ ਕਹਿੰਦੀ ਸੀ ਮੈਂ ਬਹਿਣਾ ਅਤੇ ਮੈਂ ਕਹਿੰਦੀ ਸੀ ਨਹੀਂ ਮੈਂ ਬਹਿਣਾ ਫਿਰ ਤੁਹਾਨੂੰ ਪਤਾ ਹੈ ਕਿ ਜਿਵੇਂ ਬੱਸ ਵਿੱਚ ਬੈਠੋ ਇੱਦਾਂ ਘੁੰਮਣ ਜਾਓ ਬਾਹਰ ਦਾ ਦ੍ਰਿਸ਼ ਦੇਖੋ ਅਤੇ ਖਾਣ ਪੀਣ ਦਾ ਮਨ ਤਾਂ ਕਰਦਾ ਹੀ ਹੈ ਫਿਰ ਮੈਂ ਕੁਛ ਖਾਣ ਪੀਣ ਦੇ ਪੈਕਟ ਜੋ ਕਿ ਰਾਤ ਨੂੰ ਹੀ ਲਿਤੇ ਹੋਏ ਸੀ ਫਿਰ ਆਪਾਂ ਦੋਨਾਂ ਭੈਣਾਂ ਨੇ ਬਹਿ ਕੇ ਇੱਕ ਇੱਕ ਪੈਕਟ ਖਾਧੇ ਫਿਰ ਹੋਰ ਵੀ ਆਪਾਂ ਕਾਫ਼ੀ ਚੀਜ਼ਾਂ ਲਿੱਤੀਆਂ ਸੀ ਜੋ ਕਿ ਅਸੀਂ ਬੜੇ ਆਨੰਦ ਮਾਣ ਕੇ ਖਾਧੇ ਫਿਰ ਅਸੀਂ ਰਾਹ ਵਿੱਚ ਬਿਆਸ 'ਤੇ ਆਪਣੀ ਬੱਸ ਖਲਾਰੀ ਜਿੱਥੇ ਕਿ ਅਸੀਂ ਚਾਹ ਪੀਤੀ ਚਾਹ ਨਾਲ਼ ਮੱਠੀਆਂ ਖਾਧੀਆਂ ਬਹੁਤ ਮਜ਼ਾ ਆਇਆ ਸਾਨੂੰ ਫਿਰ ਸਾਡੀ ਬੱਸ ਤੁਰ ਪਈ ਫਿਰ ਅਸੀਂ ਬੱਸ ਵਿੱਚ ਬੈਠੇ ਫਿਰ ਅਸੀਂ ਬੱਸ ਵਿੱਚ ਤਿੰਨ ਕੁ ਵਜੇ ਦੇ ਕਰੀਬ ਸਾਡੀ ਬੱਸ ਫਿਰ ਖਲੋਤੀ ਫਿਰ ਅਸੀਂ ਰਾਹ ਵਿੱਚ ਰੁਕ ਕੇ ਪੂੜੀ ਛੋਲੇ ਲੱਸੀ ਚਾਹ ਫਿਰ ਦੁਬਾਰਾ ਪੀਤੀ ਜੋ ਕਿ ਅਸੀਂ ਗਾਂਹ ਜਾ ਕੇ ਫਿਰ ਗੁਰਦੁਆਰੇ 'ਚ ਗਏ ਗੁਰਦੁਆਰੇ ਵੀ ਅਸੀਂ ਉਤਰ ਗਏ ਪਹਿਲਾਂ ਆਪਣੇ ਕਮਰੇ ਵਿੱਚ ਇਸ਼ਨਾਨ ਕੀਤਾ ਫਿਰ ਅਸੀਂ ਬਾਬਾ ਜੀ ਦੇ ਦਰਸ਼ਨ ਕੀਤੇ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਖਰੀਦਾ ਖਰਾਦੀ ਕੀਤੀ ਫਿਰ ਜੋ ਅਸੀਂ ਆਪਣੀ ਫਿਰ ਦੁਬਾਰਾ ਉਸੇ ਬੱਸ ਵਿੱਚ ਬਹਿ ਕੇ ਰਾਤ ਨੂੰ ਘਰ ਆਏ ਰਾਤ ਨੂੰ ਘਰ ਆ ਕੇ ਧੰਨਵਾਦ